ਹਾਂਜੀ ਸਾਨੂੰ ਵਕੀਲ ਪੁਲਿਸ ਪੰਚਾਇਤਾਂ ਤਹਿਸੀਲ ਵਰਗੇ ਦਫਤਰਾਂ ਦੇ ਲੋਕਾਂ ਵਰਗੇ ਕਾਨੂੰਨੀ ਅਧਿਕਾਰੀਆਂ ਕਾਰਨ ਕੋਈ ਬਹੁਤ ਮੁਸ਼ਕਿਲ ਆਈ ਹੈ ਇੱਕ ਵਾਰ ਸਾਡੇ ਨਾਲ ਸਾਡੇ ਗਵਾਂਢੀਆਂ ਦੀ ਲੜਾਈ ਹੋ ਗਈ ਸੀਗੀ ਜਿਸਦੇ ਵਿੱਚ ਪੁਲਿਸ ਵਰਗੇ ਅਧਿਕਾਰੀਆਂ ਸ਼ਾਮਿਲ ਸ਼ਾਮਿਲ ਹੋਏ ਸੀਗੇ ਕਿਉਂਕਿ ਜਦੋਂ ਸਾਡੇ ਨਾਲ ਲੜਾਈ ਹੋ ਗਈ ਸੀ ਤਾਂ ਉੱਥੇ ਪੁਲਿਸ ਆ ਚੁੱਕੀ ਸੀਗੀ ਜਿਸ ਕਰਕੇ ਸਾਡੇ ਨਾਲ ਉਹਨਾਂ ਨੇ ਬਹੁਤ ਹੀ ਬੁਰਾ ਵਿਉਹਾਰ ਕੀਤਾ ਕਿਉਂਕਿ ਸਾਡੀ ਲ ਗਲਤੀ ਵੀ ਕੋਈ ਨਹੀਂ ਸੀ ਤਾਂ ਉਹਨਾਂ ਨੇ ਸਾਨੂੰ ਲੱਖ ਰੁਪਏ ਦਾ ਜੁਰਮਾਨਾ ਲਗਾ ਦਿੱਤਾ ਸੀਗਾ ਸਾਰੀ ਗਲਤੀ ਦੂਜੇ ਗੁਆਂਢੀਆਂ ਦੀ ਸੀਗੀ ਤਾਂ ਫਿਰ ਉਸ ਸਾਨੂੰ ਉਹ ਹਰਜਾਨਾ ਸਾਨੂੰ ਭਰਨਾ ਪਿਆ ਜਿਸ ਦੇ ਨਾਲ ਉਹ ਜਿਹੜਾ ਜੁਰਮਾਨਾ ਸੀਗਾ ਉਹ ਅਸੀਂ ਭਰਨ ਲਈ ਸਾਡੇ ਕੋਲੇ ਇੰਨੇ ਪੈਸੇ ਵੀ ਨਹੀਂ ਸੀਗੇ ਇਸ ਤਰ੍ਹਾਂ ਸਾਨੂੰ ਭ੍ਰਿਸ਼ਟਾਚਾਰ ਦਾ ਅਨੁਭਵ ਹੋਇਆ ਵੀ ਜਿਹੜੇ ਲੋਕ ਨੇਗੇ ਪੈਸੇ ਖਾ ਲੈਂਦੇ ਨੇਗੇ ਤਾਂ ਫਿਰ ਉਹ ਜਿਹੜੇ ਪੈਸੇ ਸੀਗੇ ਜੁਰਮਾਨਾ ਸੀ ਉਹ ਸਾਨੂੰ ਭਰਨਾ ਪਿਆ ਇਸ ਤਰ੍ਹਾਂ ਵਕੀਲ ਪੁਲਿਸ ਜਾਂ ਤਹਿਸੀਲ ਵਾਲੇ ਦਫਤਰਾਂ ਵਰਗੇ ਲੋਕਾਂ ਦੇ ਅੱਗੇ ਕਾਨੂੰਨੀ ਅਧਿਕਾਰੀਆਂ ਕਾਰਨ ਬਹੁਤ ਮੁਸ਼ਕਿਲ ਆਈ